ਹਾਂਜੀ ਬੌਬੀ ਟ੍ਰੈਵਲ ਏਜੰਸੀ ਤੋਂ ਬੋਲਦੇ ਹੋ ਉਹ ਕੱਲ ਬਾਈ ਯਾਰ ਤੁਹਾਡੇ ਤੋਂ ਨਾ ਕਾਰ ਬੁੱਕ ਟੈਕਸੀ ਮੰਗਵਾਈ ਸੀ ਇੱਥੋਂ ਰੋਪੜ ਤੋਂ ਪਟਿਆਲੇ ਜਾਣ ਲਈ ਨਾ ਤਾਂ ਡਰਾਈਵਰ ਨੇ ਤੁਹਾਡੇ ਨੇ ਮਾਸਕ ਪਹਿਨਿਆ ਹੋਇਆ ਉਹਨੇ ਐਨੀ ਗੱਡੀ ਦੀਆਂ ਗ ਸੀਟਾਂ ਗੰਦੀਆਂ ਉਹਦੇ 'ਚ ਬੈਠੇ ਤਾਂ ਮੁਸ਼ਕ ਮਾਰਦੀ ਆ ਬੁਰਾ ਹਾਲ ਹੋ ਗਿਆ ਯਾਰ ਪਟਿਆਲੇ ਤੱਕ ਪਹੁੰਚਦੇ ਪਹੁੰਚਦੇ ਕਿਰਪਾ ਕਰਕੇ ਅੱਗੇ ਤੋਂ ਨਾ ਏਦਾਂ ਦਾ ਕੁਛ ਕਰਿਆ ਕਰੋ ਚੱਜ ਦੀ ਗੱਡੀ ਭੇਜਿਆ ਕਰੋ